ਨੌਂ ਸੌ ਪੰਦਰ੍ਹਾਂ ਗਿਆਰ੍ਹਾਂ ਸੌ ਪੰਜਾਹ ਪਚਵੰਜਾ ਪੰਜ ਸੌ ਪਚਵੰਜਾ ਪੈਂਹਠ ਹਜ਼ਾਰ ਨੌਂ ਸੌ ਸਤਾਸੀ ਅੱਠ ਲੱਖ ਸਤਾਨਵੇਂ ਹਜ਼ਾਰ ਤਿੰਨ ਸੌ ਤਰਤਾ